ਮੈਂ ਬਾਗਬਾਨੀ ਦੇ ਲਈ ਇੱਕ ਰੰਬਾ ਰੱਖਿਆ ਹੋਇਆ ਅਤੇ ਗਮਲੇ ਰੱਖੇ ਨੇ ਗਮਲਿਆਂ ਦੇ ਵਿੱਚ ਰੰਬੇ ਦੇ ਨਾਲ ਖੁਦਾਈ ਕਰਕੇ ਉਹਦੇ ਵਿੱਚ ਪਾ ਲਈਦਾ ਅਤੇ ਇੱਕ ਦਾਬੜਾ ਰੱਖਿਆ ਦਾਬੜੇ ਦੇ ਵਿੱਚ ਮਿੱਟੀ ਵਗੈਰਾ ਜਾਂ ਉਹਨਾਂ ਨੂੰ ਰੂੜੀ ਪਾਣੀ ਹੁੰਦੀ ਆ ਉਹ ਪਾ ਲਈ ਦੀ ਏ